ਮੈਂ ਰੋਜ਼ਾਨਾ ਦੇ ਆਧਾਰ 'ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਦਾ ਹਾਂ ਜਿਨ੍ਹਾਂ ਵਿੱਚੋਂ ਵਟਸਐਪ ਇੰਸਟਾਗ੍ਰਾਮ ਫੇਸਬੁੱਕ ਅਤੇ ਯੂਟਿਊਬ ਅਤੇ ਗੂਗਲ ਸਭ ਤੋਂ ਜ਼ਿਆਦਾ ਹਨ ਮੈਂ ਇਹ ਮੀਡੀਆ ਇੰਟਰਟੈਨਮੈਂਟ ਵਾਸਤੇ ਜਾਂ ਫਿਰ ਕੋਈ ਨੋਲੇਜ ਲੈਣ ਲਈ ਵਰਤਦਾ ਹਾਂ ਪਰ ਵਟਸਐਪ ਮੈਂ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲ ਚੈਟ ਕਰਨ ਲਈ ਅਤੇ ਵੀਡੀਓ ਕੋਲ ਕਰਨ ਲਈ ਯੂਜ ਕਰਦਾ ਹਾਂ ਇਸ ਵਿੱਚ ਅਸੀਂ ਸਾਰੇ ਦੋਸਤਾਂ ਨੇ ਗਰੁੱਪ ਬਣਾਇਆ ਹੈ ਅਤੇ ਕਈ ਵਾਰੀ ਗਰੁੱਪ ਵੀਡੀਓ ਕਾਲ ਵੀ ਕਰ ਲੈਂਦੇ ਹਾਂ ਟਵੀਟਰ ਟਵੀਟਰ ਦੀ ਵਰਤੋਂ ਮੈਂ ਬਹੁਤ ਘੱਟ ਕਰਦਾ ਹਾਂ ਪਰ ਜਦੋਂ ਕੋਈ ਵੀ ਕੰਟਰੋਵਰਸੀ ਹੁੰਦੀ ਹੈ ਭਾਵੇਂ ਪੋਲੀਟਿਕਸ ਜਾਂ ਕੁਝ ਵੀ ਮੁੱਦੇ ਤਾਂ ਮੈਂ ਟਵਿੱਟਰ ਪੜ੍ਹਨ ਲਈ ਟਵਿੱਟਰ ਦੀ ਵਰਤੋਂ ਕਰਦਾ ਹਾਂ ਯੂਟਿਊਬ ਦੀ ਵਰਤੋਂ ਮੈਂ ਵੀਡੀਓ ਦੇਖਣ ਵਾਸਤੇ ਕਰਦਾ ਹਾਂ ਗੇਮਸ ਦੇ ਬਲੋਗ ਦੇਖਣ ਲਈ ਲਾਈਵ ਸੈਸ਼ਨ ਵੀ ਦੇਖ ਦੇਖਣ ਲਈ ਮੈਂ ਯੂਟਿਊਬ ਦੀ ਵਰਤੋਂ ਕਰਦਾ ਹਾਂ ਗੂਗਲ ਗੂਗਲ ਦਾ ਯੂਜ ਮੈਂ ਡੇਲੀ ਅਪਡੇਟਸ ਦੇਖਣ ਲਈ ਕਰਦਾ ਹਾਂ ਇਨ੍ਹਾਂ ਸਾਰੇ ਸੋਸ਼ਲ ਮੀਡੀਆ ਪਲੈਟਫੋਰਮ ਨੇ ਦੁਨੀਆ ਨੂੰ ਦੇਖਣ ਦਾ ਇੱਕ ਵੱਖਰਾ ਅੰਦਾਜ਼ ਅਤੇ ਦ੍ਰਿਸ਼ਟੀਕੋਣ ਦਿੱਤਾ ਹੈ